ਪੇਂਟਿੰਗ ਵਿੱਚ ਮੇਰੀ ਇੰਨੀ ਜ਼ਿਆਦਾ ਰੁਤਾ ਰੁਚੀ ਨਹੀਂ ਹੈਗੀ ਪਰ ਅਸੀਂ ਪਟਿਆਲੇ ਰਹਿੰਦੇ ਹਾਂ ਜਾਂ ਪਟਿਆਲੇ ਦੇ ਵਿੱਚ ਪੰਜਾਬੀ ਯੂਨੀਵਰਸਿਟੀ 'ਚ 'ਚ ਮੈਨੂੰ ਕੰਮ ਕਰਨ ਦਾ ਮੌਕਾ ਮਿਲਿਆ ਹੈਗਾ ਅਤੇ ਇੱਥੇ ਬਹੁਤ ਹੀ ਵੱਖ ਵੱਖ ਕੋਰਸ ਹੈਗੇ ਨੇ ਜਿਵੇਂ ਪੇਂਟਿੰਗ ਦਾ ਹੋਰ ਡਿਪਾਰਟਮੈਂਟ ਬਣੇ ਹੋਏ ਆ ਇੱਥੇ ਨਾ ਪੇਂਟਿੰਗ ਦੇ ਬੱਚਿਆਂ ਦੇ ਆਏ ਸਾਲ ਮਤਲਬ ਕੋਰਸ ਕਰਵਾਏ ਜਾਂਦੇ ਆ ਨਵੇਂ ਨਵੇਂ ਅਤੇ ਕੰਪਟੀਸ਼ਨ ਵੀ ਹੁੰਦੇ ਨੇ ਦੇਖ ਕੇ ਜਿਹੜਾ ਕਿ ਸਾਨੂੰ ਮਨ ਨੂੰ ਬੜੀ ਪ੍ਰੇਰਨਾ ਸਰੋਤ ਹੁੰਦੀ ਹੈ ਕਿ ਬੱਚੇ ਦੇਖ ਦੇਖ ਵੱਖ ਵੱਖ ਚੀਜ਼ਾਂ ਆਪਦੇ ਦਿਮਾਗ ਨਾਲ ਸੋਚ ਕੇ ਬਣਾਉਂਦੇ ਹਨ ਜੋ ਕਿ ਮਨ ਨੂੰ ਬਹੁਤ ਹੀ ਮੋਹਕ ਲੱਗਦਾ ਹੈ ਕਿ ਆਹਾ ਕਿਉਂ ਕਿਆ ਬਾਤ ਹੈ ਕਿ ਜਵਾਕਾਂ 'ਚ ਇੰਨਾ ਜ਼ਿਆਦਾ ਟੈਲੈਂਟ ਹੈਗਾ ਉਹ ਆਪਣੇ ਮਨ ਦੇ ਅੰਦਰੋਂ ਘੜਤ ਕਰਕੇ ਗੱਲਾਂ ਸੋਚ ਕੇ ਵਿਚਾਰ ਕੇ ਉਹਨਾਂ ਨੂੰ ਟੋਪਿਕ ਮਿਲਦਾ ਤਾਂ ਅਸੀਂ ਦੇਖਦੇ ਹਾਂ ਕਿ ਦਿਮਾਗ ਬੱਚਿਆਂ ਦਾ ਕਿੰਨਾ ਤੇਜ਼ ਹੈ ਅਤੇ ਉਹ ਦੇਖਣ ਦਾ ਸਾਨੂੰ ਤਾਂ ਰਹਿਣ ਦਾ ਅਤੇ ਸਾਰਾ ਸੁਭਾਗ ਪ੍ਰਾਪਤ ਹੋਇਆ